ਮੇਰਾ ਨਾਮ ਕਿਰਨਜੀਤ ਕੌਰ ਹੈ ਮੈਂ ਮੈਰਿਡ ਹੈ ਦੋ ਬੱਚੇ ਹੈ ਜੀ ਮੇਰੇ ਬੇਟੀ ਜੈਸਲੀਨ ਕੌਰ ਬੇਟਾ ਸਹਿਬਾਜ ਸਿੰਘ ਔਰ ਹਸਬੈਂਡ ਮੇਰੇ ਪ੍ਰਾਈਵੇਟ ਜੋਬ ਕਰਦੇ ਹੈ ਘਰ ਵਿੱਚ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਮੈਨੂੰ ਬਹੁਤ ਅੱਛਾ ਲੱਗਦਾ ਅਰ ਜਦੋਂ ਵੀ ਫਰੀ ਹੁੰਦੇ ਹੈ ਅ ਜਾਂ ਸੰਡੇ ਨੂੰ ਅਸੀਂ ਗੁਰੂ ਘਰ ਜਾਣਾ ਜ਼ਿਆਦਾ ਪਸੰਦ ਕਰਦੇ ਹੈ ਬੱਚਿਆਂ ਨਾਲ ਟਾਈਮ ਕਦੋਂ ਨਿਕਲ ਜਾਂਦਾ ਪਤਾ ਹੀ ਨਹੀਂ ਚੱਲਦਾ ਫਰੀ ਟਾਈਮ ਰੀਡਿੰਗ ਕਰਨਾ ਜਾਂ ਕੁਕਿੰਗ ਕਰਨਾ ਜਾਂ ਕੁਛ ਬੈਸਟ ਆਊਟ ਆਫ ਵੇਸਟ ਐਦਾਂ ਦਾ ਕੁਛ ਬਣਾਉਣਾ ਉਹ ਮੈਨੂੰ ਜ਼ਿਆਦਾ ਵਧੀਆ ਲੱਗਦਾ ਖਾਣ ਪੀਣ ਦੀ ਰੈਸਪੀਜ਼ ਹੋ ਗਈਆਂ ਬੱਚਿਆਂ ਲਈ ਕੁਝ ਸਪੈਸ਼ਲ ਕਰਨਾ ਜਾਂ ਉਹਨਾਂ ਦੀ ਕੋਈ ਟਾਸਕ ਹੁੰਦੀ ਸਕੂਲ ਦੇ ਉਹਨੂੰ ਇਨੀਸ਼ੀਏਟਿਵ ਲੈਣਾ ਕਿ ਹਾਂਜੀ ਬੱਚੇ ਦਾ ਆਹ ਕੰਮ ਹੈ ਅਸੀਂ ਅੱਗੇ ਹੋ ਕੇ ਕਰਦੇ ਹੈ ਇਹ ਚੀਜ਼ਾਂ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਕਿ ਬੱਚੇ ਦਾ ਕੋਈ ਪ੍ਰਾਈਜ਼ ਆਉਂਦਾ ਉਹਦੇ ਉਹ ਸਾਡੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਹਾਂਜੀ ਅਸੀਂ ਐਫਰਟਸ ਕੀਤੇ ਤਾਂ ਕਰਕੇ ਉਹਦਾ ਇਹ ਰਿਜਲਟ ਆਇਆ ਔ ਔਰ ਠੀਕ ਹੈ ਲਾਈਫ ਵਿੱਚ ਅੱਗੇ ਵੱਧਣਾ ਔਰ ਪੋਜ਼ੀਟਿਵ ਐਟੀਟਿਊਡ ਰੱਖ ਕੇ ਅਸੀਂ ਚਲਦੇ ਹੈ ਬਸ ਇਹੀ ਹੈ ਲਾਈਫ ਬੱਚਿਆਂ ਨਾਲ ਚੱਲ ਰਹੀ ਹੈ ਵਧੀਆ ਥੈਂਕ ਯੂ